ਗੁੱਡ ਮੋਰਨਿੰਗ ਹਾਂਜੀ ਹਾਂ ਹਾਂਜੀ ਮੈਮ ਤੁਹਾਡਾ ਨਾਮ ਕੀ ਹੈ ਹਾਂਜੀ

ਹਾਂਜੀ ਮੈਮ ਇੱਕ ਗੱਲ ਇੱਦਾਂ ਹੈ ਕਿ ਤੁਸੀਂ ਛੁੱਟੀਆਂ ਬਹੁਤ ਕੀਤੀਆਂ ਇਸ ਮੰਥ ਵਿੱਚ ਹਾਂਜੀ ਹਾਂਜੀ ਮੈਮ ਉਹ ਤਾਂ ਠੀਕ ਹੈ ਬਟ ਸਾਨੂੰ ਵੀ ਪ੍ਰੋਬਲਮ ਆ ਰਹੀ ਹੈ ਵੀ ਕੰਮ ਕਿੱਦਾਂ ਹੋਵੇਗਾ ਅਗਰ ਤੁਸੀਂ ਵੀ ਬਾਕੀ ਵੀ ਬਾਕੀ ਵੀ ਲੀਵ 'ਤੇ ਹੋਣ ਤਾਂ ਫਿਰ ਕੰਮ ਕਿੱਦਾਂ ਚੱਲੇਗਾ ਇਹ ਦੱਸੋ ਤੁਸੀਂ ਮੈਨੂੰ ਹਾਂਜੀ ਮੈਮ ਦੇਖੋ ਤੁਸੀਂ ਹਰ ਮੰਥ ਛੁੱਟੀ ਛੁੱਟੀਆਂ ਲੈ ਹੀ ਜਾਂਦੇ ਹੋ ਇਸ ਕਰਕੇ ਥੋੜ੍ਹਾ ਸੋਰੀ ਮੈਮ ਮੈਂ ਤੁਹਾਨੂੰ ਕੁਝ ਇਹ ਤੁਹਾਨੂੰ ਮੈਂ ਥੋੜ੍ਹੀ ਦੇਰ ਤੱਕ ਦੱਸੂਗੀ ਅਤੇ ਤੁਸੀਂ ਆਪਣਾ ਰੈਗੂਲਰ ਆਓ

ਹਾਂ ਹਾਂ ਜੀ ਉੱਥੇ ਚਲੋ ਤੁਸੀਂ ਜਦੋਂ ਤੁਸੀਂ ਰੈਗੂਲਰ ਹੋ ਗਏ ਨਾ ਮੈਂ ਆਟੋਮੈਟਿਕਲੀ ਤੁਹਾਡੀ ਇੰਕਰੀਮੈਂਟਲ ਕਰ ਦੇਣੀ ਹਾਂਜੀ ਹਾਂਜੀ ਮੈਮ ਵੈਸੇ ਤੁਸੀਂ ਕਰੋ ਕਿ ਅਗਰ ਤੁਸੀਂ ਕੋਈ ਅਰਜੈਂਟ ਵਰਕ 'ਤੇ ਆ ਤਾਂ ਤੁਸੀਂ ਵੀ ਇਨਫੋਰਮ ਕਰੋ ਪਹਿਲਾਂ ਚਲੋਂ ਸੀਕ ਲੀਵ 'ਤੇ ਅਸੀਂ ਹਾਂ ਮੈਮ ਤੁਸੀਂ ਡਾਕਟਰ ਕੋਲ ਸਰਟੀਫਿਕੇਟ ਦੇਣਾ ਸੀ ਨਾ ਸਰਟੀਫਿਕੇਟ ਨਹੀਂ ਡਿਪੋਜਿਟ ਕਰਵਾਇਆ ਮੈਡੀਸਨ ਮੈਡੀਸਨ ਵਾਲੇ ਕੋਲ ਵੀ ਤੁਸੀਂ ਡਿਪੋਜਿਟ ਕਰਵਾ ਦਓਗੇ ਫਿਰ ਇਸ ਤੋਂ ਬਾਅਦ ਮੈਂ ਸੋਚੂਗੀ ਇੰਕਰੀਮੈਂਟ ਲਗਵਾਉਣ ਵਾਸਤੇ ਠੀਕ ਹੈ ਹਾਂਜੀ ਓਕੇ ਓਕੇ ਮੈਮ